ਭੰਗੜੇ ਦੇ ਅਲੱਗ ਅਲੱਗ ਸਟੈਪ ਹੁੰਦੇ ਨੇ ਜਿੱਦਾਂ ਚੁਟਕੀ ਹੋ ਗਿਆ ਜੁਗਨੀ ਹੋ ਗਿਆ ਮੋਰ ਹੋ ਗਿਆ ਅਲੱਗ ਅਲੱਗ ਤਰ੍ਹਾਂ ਦੇ ਭੰਗੜੇ ਨੇਗੇ ਇਹ ਸਭ ਪੰਜਾਬੀ ਸੱਭਿਆ ਜਿੱਦਾਂ ਹੁਣ ਆਪਣੀ ਜਿਮ ਹੋ ਗਿਆ ਜਿਮ ਦੇ ਵਿੱਚ ਵੀ ਆਪਾਂ ਭੰਗੜਾ ਪਾਉਣ ਪਾਉਂਦੇ ਨੇਗੇ ਨਾਲ ਹੀ ਆਪਣਾ ਯੋਗਾ ਹੋਈ ਜਾਂਦਾ ਕਿ ਨਾਲ ਹੀ ਨਾਲ ਦੀ ਨਾਲ ਆਪਾਂ ਭੰਗੜਾ ਪਾਈ ਜਾਂਦੇ ਆਗੇ ਅਤੇ ਉਸ ਤੋਂ ਬਾਅਦ ਵਿਆਹਾਂ ਦੇ ਵਿੱਚ ਲਾ ਲਓ ਤੁਸੀਂ ਵਿਆਹਾਂ ਦੇ ਵਿੱਚ ਭੰਗੜਾ ਪੈਂਦਾ ਹੀ ਪੈਂਦਾ ਭੰਗੜੇ ਤੋਂ ਬਿਨਾ ਵਿਆਹ ਜਚਦਾ ਹੀ ਨਹੀਂ ਹੈਗਾ ਅਤੇ ਕੋਈ ਵੀ ਫੰਕਸ਼ਨ ਹੋ ਗਿਆ ਕੋਈ ਵੀ ਜਨਮਦਿਨ ਹੋ ਗਿਆ ਹਰ ਇੱਕ ਜਗ੍ਹਾ 'ਤੇ ਭੰਗੜਾ ਪੈਂਦਾ ਹੀ ਪੈਂਦਾ ਹੈਗਾ ਉਸ ਤੋਂ ਬਾਅਦ ਜਿਵੇਂ ਆਪਣੇ ਮਾਇੰਡ ਨੂੰ ਆਪਣੇ ਫਰੈਸ਼ ਕਰਨਾ ਹੋਵੇ ਉਸ ਦੇ ਲਈ ਵੀ ਆਪਾਂ ਭੰਗੜਾ ਪਾ ਸਕਦੇ ਹਾਂਗੇ ਆਪਣੇ ਦਿਮਾਗ ਦੇ ਵਿੱਚੋਂ ਕੋਈ ਵੀ ਸਟਰੈਸ ਹੋਵੇ ਨਿਕਲ ਜਾਂਦਾ ਗਾ ਅਤੇ ਭੰਗੜੇ ਦੇ ਕੁਛ ਆਮ ਸਟੈਪ ਹੁੰਦੇ ਨੇਗੇ ਜੋ ਅਲੱਗ ਅਲੱਗ ਤਰ੍ਹਾਂ ਪਾਏ ਜਾਂਦੇ ਨੇਗੇ ਕਿ ਮੋਰਨੀ ਹੁੰਦਾ ਸੀਗਾ ਮੋਰਨੀ ਭੰਗੜਾ ਪਾਇਆ ਜਾਂਦਾ ਸੀ ਜੁਗਨੀ ਹੁੰਦਾ ਸੀਗਾ ਜੁਗਨੀ ਭੰਗੜਾ ਪਾਇਆ ਜਾਂਦਾ ਸੀਗਾ ਝੂਮਰ ਹੋ ਗਿਆ ਜੀ ਅਲੱਗ ਅਲੱਗ ਤਰ੍ਹਾਂ ਦੇ ਸਟੈਪ ਨੇਗੇ ਭੰਗੜੇ ਦੇ ਜੋ ਆਪਾਂ ਪਾ ਸਕਦੇ ਹਾਂ ਅਤੇ ਸੱਭਿਆਚਾਰ ਪੰਜਾਬੀਆਂ ਦੇ ਵਿੱਚ ਤਾਂ ਭੰਗੜਾ ਪੰਜਾਬੀਆਂ ਦੀ ਮੇਨ ਜਾਨ ਹੈ ਜੀ ਪੰਜਾਬ ਦਾ ਮੇਨ ਫੇਮਸ ਫੇਮਸ ਕਲਚਰ ਫੇਮਸ ਇੱਕ ਤਰ੍ਹਾਂ ਦਾ ਮੰਨਿਆ ਜਾਂਦਾ ਹੈਗਾ ਭੰਗੜਾ